ਭੰਗੜੇ ਦੇ ਆਮ ਸਟੈਪ ਅਤੇ ਪੰਜਾਬੀ ਸੱਭਿਆਚਾਰ ਵਿੱਚ ਉਹਨਾਂ ਦੀ ਮਹੱਤਤਾ ਭੰਗੜਾ ਇੱਕ ਅਜਿਹਾ ਨਾਚ ਹੈ ਜਿਸ ਵਿੱਚ ਸਰੀਰ ਦੀ ਹਰ ਕਰਸ ਕਸਰਤ ਖੁਸ਼ੀ ਅਤੇ ਜੋਸ਼ ਨਾਲ ਭਰੀ ਹੁੰਦੀ ਹੈ ਇਸ ਦੇ ਸਟੈਪ ਬਹੁਤ ਸਾਰੇ ਹਨ ਅਤੇ ਇਹ ਸਮੇਂ ਅਤੇ ਥਾਂ ਦੇ ਨਾਲ ਨਾਲ ਬਦਲਦੇ ਰਹਿੰਦੇ ਹਨ ਹਲਕਿਆਂ ਕੁਝ ਆਮ ਸਟੈਪ ਹਨ ਜੋ ਹਰ ਭੰਗੜੇ ਵਿੱਚ ਲੱਭੇ ਜਾ ਸਕਦੇ ਹਨ ਭੰਗੜੇ ਦੇ ਕੁਝ ਆਮ ਸਟੈਪ ਤਾਲੀਆਂ ਤਾਲੀਆਂ ਭੰਗੜਾ ਦਾ ਅਨਿੱਖੜਵਾਂ ਅੰਗ ਹੈ ਇਹ ਨਾ ਸਿਰਫ ਤਾਲ ਨੂੰ ਬਣਾਈ ਰੱਖਦਾ ਰੱਖਦੀਆਂ ਹਨ ਸਗੋਂ ਨੱਚਣ ਵਾਲਿਆਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ ਪੈਰਾਂ ਦੇ ਘੁੰਮਾਵ ਭੰਗੜੇ ਵਿੱਚ ਪੈਰਾਂ ਨੂੰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਇਹ ਸਟੈਪ ਭੰਗੜੇ ਨੂੰ ਜੋਸ਼ ਨਾਲ ਭਰ ਦਿੰਦਾ ਹੈ ਹੱਥਾਂ ਦੀਆਂ ਹਰਕਤਾਂ ਭੰਗੜੇ ਵਿੱਚ ਹੱਥਾਂ ਦੀਆਂ ਵੀ ਬਹੁਤ ਹਰਕਤਾਂ ਕੀਤੀਆਂ ਜਾਂਦੀਆਂ ਹਨ ਇਹ ਹਰਕਤਾਂ ਨਾਚ ਨੂੰ ਹੋਰ ਵੀ ਰੰਗੀਨ ਬਣਾਉਂਦੀਆਂ ਹਨ ਸਰੀਰ ਨੂੰ ਹਿਲਾਉਣਾ ਭੰਗੜੇ ਵਿੱਚ ਸਾਰੇ ਸਰੀਰ ਨੂੰ ਹਿਲਾਇਆ ਜਾਂਦਾ ਹੈ ਇਸ ਵਿੱਚ ਕਮਰ ਨੂੰ ਹਿਲਾਉਣਾ ਮੋਢੇ ਨੂੰ ਹਿਲਾਉਣਾ ਅਤੇ ਸਿਰ ਨੂੰ ਹਿਲਾਉਣਾ ਸੰਭਵ ਹੈ ਭੰਗੜੇ ਦੇ ਸਟੈਪ ਅਤੇ ਪੰਜਾਬ ਸੱਭਿਆਚਾਰ ਭੰਗੜੇ ਦੇ ਇਹ ਸਟੈਪ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੇ ਹਨ ਜੋਸ਼ ਅਤੇ ਉਤਸ਼ਾਹ ਭੰਗੜੇ 'ਤੇ ਤੇਜ਼ ਸਟੈਪ ਅਤੇ ਲਾਤੀਆਂ ਨੱਚਣ ਵਾਲਿਆਂ ਵਿੱਚ ਜੋਸ਼ ਅਤੇ ਇਤਿਹਾਸ ਪੈਦਾ ਕਰਦੀਆਂ ਹਨ ਇਹ ਪੰਜਾਬ ਦੇ ਜੋਸ਼ੀਲੇ ਸੁਭਾਅ ਨੂੰ ਦਰਸਾਉਂਦੀਆਂ ਹਨ ਖੁਸ਼ੀ ਭੰਗੜੇ ਦੇ ਹਰ ਸਟੈਪ ਵਿੱਚ ਖੁਸ਼ੀ ਦੇ ਝਲਕਦੀ ਹੈ ਪੰ ਇਹ ਪੰਜਾਬ ਦੇ ਜੀਵਨ ਨੂੰ ਖੁਸ਼ ਨਾਲ ਜੀਣ ਦੇ ਤਰੀਕੇ ਨੂੰ ਦਰਸਾਉਂਦੀ ਹੈ ਸਮੂਹਿਕ ਭੰਗੜੇ ਵਿੱਚ ਸਾਰੇ ਨੱਚਣ ਵਾਲੇ ਇੱਕ ਦੂਜੇ ਨਾਲ ਮਿਲ ਕੇ ਨੱਚਦੇ ਹਨ ਇਹ ਪੰਜਾਬੀਆਂ ਦੇ ਮੋਹਿਤ ਸੁਭਾਅ ਨੂੰ ਦਰਸਾਉਂਦੀ ਹੈ ਸੌਰ ਦਿੱਤਾ ਭੰਗੜੇ ਦੇ ਸਟੈਪ ਬਹੁਤ ਸਰਲ ਹੁੰਦੇ ਹਨ ਇਹ ਕਿਸੇ ਵੀ ਉਮਰ ਦੇ ਵਿਅਕਤੀ ਦੁਆਰਾ ਸਿੱਖੇ ਜਾ ਸਕਦੇ ਹਨ ਇਹ ਪੰਜਾਬ ਦੀ ਸਰਲਤਾ ਨੂੰ ਦਰਸਾਉਂਦੇ ਹਨ ਸਿੱਟਾ ਭੰਗੜੇ ਦੇ ਸਟੈਪ ਨੂੰ ਸਿਰਫ ਇੱਕ ਨਾਚ ਹਨ ਸਗੋਂ ਪੰਜਾਬੀ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ ਹਨ ਇਹ ਸਟੈਪ ਪੰਜਾਬੀਆਂ ਦੇ ਜੋਸ਼ ਉਤਸ਼ਾਹਿਤ ਖੁਸ਼ਿਤ ਸੂਮਿਤ ਅਤੇ ਸਰਲਤਾ ਨੂੰ ਦਰਸਾਉਂਦੇ ਹਨ ਕੀ ਤੁਸੀਂ ਭੰਗੜੇ ਬਾਰੇ ਹੋਰ ਜਾਣਨ ਨੂੰ ਚਾਹੁੰਦੇ ਹੋ